ਹੈਲੋ ਹਾਂਜੀ ਜੇ ਆਪਾਂ ਆਪਣੇ ਖਾਣਾ ਪਕਾਉਣ ਦੇ ਸ਼ੌਂਕ ਬਾਰੇ ਸੋਚੀਏ ਤਾਂ ਮੈਨੂੰ ਨਿੱਕੇ ਹੁੰਦਿਆਂ ਹੀ ਸ਼ੌਂਕ ਸੀਗਾ ਖਾਣਾ ਬਣਾਉਣ ਦਾ ਪਕਾਉਣ ਦਾ ਹੈ ਨਾ ਤਾਂ ਮੈਂ ਹੌਲੀ ਹੌਲੀ ਹੌਲੀ ਹੌਲੀ ਮੰਮੀ ਦੇ ਮੰਮੀ ਨੂੰ ਦੇਖਦੀ ਰਹਿੰਦੀ ਸੀਗੀ ਖਾਣਾ ਬਣਾਉਂਦਿਆ ਤਾਂ ਧੀਰੇ ਧੀਰੇ ਧੀਰੇ ਧੀਰੇ ਮੈਨੂੰ ਵਧੀਆ ਖਾਣਾ ਬਣਾਉਣਾ ਆ ਗਿਆ ਜਿੱਦਾਂ ਕਿ ਫਿਰ ਹੌਲੀ ਹੌਲੀ ਹੌਲੀ ਹੌਲੀ ਮੈਂ ਮੰਮੀ ਦੇ ਨਾਲ ਉਹਨਾਂ ਦੀ ਹੈਲਪ ਕਰਦੀ ਰਹਿੰਦੀ ਬਾਅਦ ਵਿੱਚ ਜਦੋਂ ਮੈਂ ਬਣਾਉਣ ਯੋਗ ਹੋਈ ਤਾਂ ਮੈਨੂੰ ਮੇਰੇ ਘਰਦਿਆਂ ਨੇ ਕਿਹਾ ਮੈਨੂੰ ਮੇਰੀ ਫੈਮਿਲੀ ਨੇ ਕਿਹਾ ਕਿ ਸਾਨੂੰ ਕੋਈ ਇੱਦਾਂ ਦੀ ਡਿਸ਼ ਟੇਸਟੀ ਕਰਵਾ ਹੈ ਨਾ ਵੀ ਕੋਈ ਵਧੀਆ ਜਿਹੀ ਬਣਾਕੇ ਤਾਂ ਮੈਂ ਉਹਨਾਂ ਨੂੰ ਮੋਮਸ ਟਰਾਈ ਕਰਵਾਏ ਫਾਸਟ ਟਾਈਮ ਤਾਂ ਉਹ ਮੋਮਸ ਇੰਨੇ ਜ਼ਿਆਦਾ ਮੇਰੇ ਘਰਦਿਆਂ ਨੂੰ ਵਧੀਆ ਲੱਗੇ ਤਾਂ ਮੇਰੇ ਘਰਦਿਆਂ ਨੂੰ ਬਹੁਤ ਵਧੀਆ ਲੱਗਿਆ ਮੇਰੇ ਹੱਥਾਂ ਦਾ ਪਹਿਲੀ ਵਾਰ ਖਾਣਾ ਖਾ ਕੇ ਤਾਂ ਮੈਂ ਡਿਸ਼ ਪਹਿਲਾਂ ਛੋਟੀਆਂ ਛੋਟੀਆਂ ਡਿਸ਼ਿਜ਼ ਤਾਂ ਬਣਾਉਂਦੀ ਰਹਿੰਦੀ ਸੀਗੀ ਫਿਰ ਮੈਨੂੰ ਧੀਰੇ ਧੀਰੇ ਮੈਂ ਮੋਮੋਸ ਟਰਾਈ ਕੀਤੇ ਤਾਂ ਜਦੋਂ ਮੈਂ ਦੇਖਿਆ ਟਰਾਈ ਕਰਕੇ ਤਾਂ ਉਹ ਬਹੁਤ ਵਧੀਆ ਬਣੇ ਮੇਰੇ ਘਰਦਿਆਂ ਨੂੰ ਬਹੁਤ ਟੇਸਟੀ ਲੱਗੇ ਤਾਂ ਉਹ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਜ਼ਿਆਦਾ ਦਿਲਾਸਾ ਦਿੱਤਾ ਹੈ ਨਾ ਵੀ ਤੂੰ ਵਧੀਆ ਖਾਣਾ ਬਣਾਇਆ ਇੱਦਾਂ ਹੀ ਫਿਰ ਮੈਂ ਹੌਲੀ ਹੌਲੀ ਹੌਲੀ ਹੌਲੀ ਹੋਰ ਡਿਸ਼ਿਜ਼ ਵੱਲ ਜਾਂਦੀ ਰਹੀ ਫਿਰ ਉਹਨਾਂ ਨੂੰ ਮੈਂ ਡੇਲੀ ਡੇਲੀ ਨਵੀਂਆਂ ਤੋਂ ਨਵੀਆਂ ਡਿਸ਼ਾਂ ਜਿਹੜੀਆਂ ਕਿ ਤਿਆਰ ਕਰਕੇ ਮੈਂ ਖਵਾਉਂਦੀ ਤਾਂ ਮੇਰੇ ਘਰਦਿਆਂ ਦਾ ਰਿਸਪੋਂਸ ਬਹੁਤ ਜ਼ਿਆਦਾ ਵਧੀਆ ਸੀ ਜਿਹੜਾ ਦੇਖ ਕੇ ਮੈਨੂੰ ਵੀ ਹੈਪੀ ਮਹਿਸੂਸ ਹੁੰਦਾ ਸੀ